ਖਾਣਾ ਬਣਾਉਣ ਤੋਂ ਪਹਿਲਾਂ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਜਿਹੜਾ ਹੈ ਉਹ ਧਿਆਨ ਰੱਖਣਾ ਹੁੰਦਾ ਹੈ ਜਿਵੇਂ ਕਿ ਖਾਣਾ ਬਣਾਉਣ ਤੋਂ ਪਹਿਲਾਂ ਜਿਹੜੀ ਆਪਾਂ ਸਬਜ਼ੀ ਬਣਾਉਣੀ ਹੈ ਉਸ ਨੂੰ ਚੰਗੀ ਤਰ੍ਹਾਂ ਧੋਣਾ ਧੋ ਕੇ ਉਸ ਨੂੰ ਕੱਟਣਾ ਜਿਹੜੇ ਜਿਹੜੇ ਮਸਾਲੇ ਅਸੀਂ ਉਸ ਵਿੱਚ ਪਾਉਣੇ ਹੈ ਉਹ ਮਸਾਲਿਆਂ ਨੂੰ ਪਰੋਪਰ ਆਪਣੇ ਨੇੜੇ ਰੱਖਣਾ ਜਿਵੇਂ ਕਿ ਉਦਾਹਰਨ ਦੇ ਤੌਰ 'ਤੇ ਆਪਾਂ ਭਿੰਡੀਆਂ ਦੀ ਸਬਜ਼ੀ ਬਣਾ ਰਹੇ ਹਾਂ ਤਾਂ ਜੇ ਆਪਾਂ ਭਿੰਡੀਆਂ ਕੱਟ ਕੇ ਬਣਾਉਣੀਆਂ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਕੱਟ ਕੇ ਰੱਖਣਾ ਪੈਂਦਾ ਹੈ ਉਹਦੇ ਲਈ ਪਿਆਜ ਵੀ ਕੱਟਣਾ ਪੈਂਦਾ ਹੈ ਉਹਦੇ ਵਿੱਚ ਕਈ ਵਾਰ ਅਸੀਂ ਅੰਬ ਪਾਉਂਦੇ ਹਨ ਉਹਨਾਂ ਨੂੰ ਅੰਬ ਨੂੰ ਵੀ ਪਹਿਲਾਂ ਹੀ ਕੱਟ ਕੇ ਤਿਆਰ ਰੱਖਣਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਉਹਦੇ ਵਿੱਚ ਜਿਹੜੇ ਜਿਹੜੇ ਆਪਾਂ ਮਸਾਲੇ ਪਾਉਣੇ ਹੈ ਉਹ ਅਸੀਂ ਪਾ ਕੇ ਰੱਖ ਸਕਦੇ ਹਾਂ ਕੋਲ ਰੱਖ ਸਕਦੇ ਹਾਂ ਸਾਫ ਸਫਾਈ ਦਾ ਜਿਹੜਾ ਹੈ ਉਹ ਪੂਰਾ ਧਿਆਨ ਰੱਖਣਾ ਹੈ ਅਤੇ ਨਾਲ ਦੀ ਨਾਲ ਅਸੀਂ ਉਹਦੇ ਵਿੱਚ ਟਮਾਟਰ ਪਾਉਣੇ ਹੈ ਤਾਂ ਅਸੀਂ ਉਹਨਾਂ ਨੂੰ ਵੀ ਪਹਿਲਾਂ ਹੀ ਕੱਟ ਕੇ ਰੱਖਣਾ ਹੈ ਤਾਂ ਜੋ ਕਿ ਸਾਨੂੰ ਸਬਜ਼ੀ ਬਣਾਉਣ ਵੇਲੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ